ਅਸੀਂ ਵੀ ਘਰ 'ਚ ਪਸ਼ੂ ਰੱਖੇ ਹੋਏ ਹੈ ਜਿਨ੍ਹਾਂ ਵਿੱਚੋਂ ਚਾਰ ਤਾਂ ਗਾ ਗਾਵਾਂ ਏ ਅਤੇ ਦੋ ਮੱਝਾਂ ਏ ਦੋ ਬੱਕਰੀਆਂ ਵੀ ਰੱਖੀਆਂ ਹੋਈਆਂ ਏ ਜਦੋਂ ਇੱਕ ਗਾਂ ਨਵੇਂ ਬੱਚੇ ਨੂੰ ਆਪਣੇ ਵਛੜੇ ਨੂੰ ਜਨਮ ਦਿੰਦੀ ਹੈ ਨਾ ਤਾਂ ਉਹਦੀ ਦੇਖਭਾਲ ਕਰਨੀ ਪੈਂਦੀ ਏ ਬਹੁਤ ਜ਼ਿਆਦਾ ਕਿਉਂਕਿ ਉਹ ਇੰਨਾ ਕਮਜ਼ੋਰ ਹੁੰਦਾ ਏ ਨਾ ਉਹ ਪੈਦਾ ਹੁੰਦੇ ਤਾਂ ਆਪਣੀਆਂ ਲੱਤਾਂ 'ਤੇ ਖੜ੍ਹਾ ਨਹੀਂ ਹੋ ਸਕਦਾ ਜਦੋਂ ਉਹ ਪੈਦਾ ਹੁੰਦਾ ਹੈ ਤਾਂ ਉਹਦੇ ਸਾਰੇ ਸਰੀਰ ਦੀ ਸਾਨੂੰ ਸਫਾਈ ਕਰਨੀ ਪੈਂਦੀ ਹੈ ਜਿੱਦਾਂ ਕਿ ਉਹਦੇ ਪੂਰੇ ਸਰੀਰ ਦੀ ਅੱਖਾਂ ਦੀ ਮੂੰਹ ਦੀ ਕੰਨਾ ਦੀ ਸਾਰਾ ਸਾਫ ਕਰਨਾ ਪੈਂਦਾ ਫਿਰ ਉਹਦੇ ਬੈਠਣ ਨੂੰ ਵੀ ਸਾਨੂੰ ਨਾ ਨੀਚੇ ਨਾ ਪਰਾਲੀ ਵਿਛਾਉਣੀ ਪੈਂਦੀ ਹੈ ਤਾਂ ਕਿ ਉਹਨੂੰ ਬੈਠਣ 'ਚ ਕੋਈ ਦਿੱਤਕ ਨਾ ਆਵੇ ਕਿਉਂਕਿ ਉਹ ਹਜੇ ਛੋਟਾ ਬੱਚਾ ਹੁੰਦਾ ਉਹਦਾ ਜੋ ਹੁੰਦਾ ਏ ਸਕਿੱਨ ਹੁੰਦੀ ਹੈ ਉਹ ਬਹੁਤ ਜ਼ਿਆਦਾ ਨਰਮ ਹੁੰਦੀ ਹੈ ਪਹਿਲਾ ਦੁੱਧ ਉਹਨੂੰ ਬੋਤਲ ਨਾਲ ਪਿਲਾਇਆ ਜਾਂਦਾ ਹੈ ਫਿਰ ਦੂਸਰੇ ਦਿਨ ਤੱਕ ਉਹ ਆਪਣੇ ਪੈਰਾਂ 'ਤੇ ਖੜ੍ਹਨ ਜੋਗਾ ਹੋ ਜਾਂਦਾ ਫਿਰ ਉਹ ਆਪਣੀ ਮਾਂ ਕੋਲ ਜਾ ਕੇ ਦੁੱਧ ਪੀਂਦਾ ਏ ਜਦੋਂ ਵੀ ਨ ਉਨ੍ਹਾਂ ਨੂੰ ਨਵਾਉਣਾ ਪੈਂਦਾ ਸਾਨੂੰ ਟਾਈਮ ਨਾਲ ਫਿਰ ਉਨ੍ਹਾਂ ਦਾ ਜਿਹੜਾ ਗੋਹਾ ਕੂੜਾ ਹੁੰਦਾ ਉਹ ਵੀ ਸਾਨੂੰ ਹੇਠਾਂ ਤੋਂ ਟਾਈਮ ਨਾਲ ਸਫਾਈ ਕਰਨੀ ਪੈਂਦੀ ਹੈ ਪੱਖੇ ਲਗਾਉਣੇ ਪੈਂਦੇ ਹੈ ਤਾਂ ਕਿ ਉਨ੍ਹਾਂ ਨੂੰ ਗਰਮੀ ਨਾ ਲੱਗੇ ਫੇਰ ਸਾਨੂੰ ਜਦੋਂ ਮੱਛਰ ਹੁੰਦਾ ਏ ਸਾਨੂੰ ਅੱਗ ਬਾਲ ਕੇ ਧੂੰਹਾਂ ਧੂਖਾਉਣਾ ਪੈਂਦਾ ਏ ਤਾਂ ਕਿ ਉਹ ਧੂੰਹੇਂ ਦੇ ਨਾਲ ਮੱਛਰ ਉਨ੍ਹਾਂ ਦੇ ਕੋਲ ਨਾ ਆਵੇ ਇਸ ਕਰਕੇ ਨਾ ਸਾਨੂੰ ਛੋਟੇ ਜੰਮੇ ਪਸ਼ੂਆਂ ਦੀ ਬਹੁਤ ਜ਼ਿਆਦਾ ਦੇਖਭਾਲ ਕਰਂਦਾ ਤਾਂ ਪੈਂਦੀ ਹੈ